ਮੈਂ ਸਮਝਦਾ ਹਾਂ ਬੈਂਕਿੰਗ ਅਤੇ ਬੀਮਾ ਖੇਤਰ ਨੇ ਬਹੁਤ ਹੀ ਜ਼ਿਆਦਾ ਪਰਿਵਰਤਨ ਕੀਤਾ ਹੈ ਇਹਨਾਂ ਨੇ ਲੈਣ ਦੇਣ ਤੇ ਭੁਗਤਾਨ ਦਾ ਤਰੀਕਾ ਵੀ ਬਦਲ ਦਿੱਤਾ ਹੈ ਅੱਜ ਦੇ ਸਮੇਂ ਵਿੱਚ ਹਰ ਚੀਜ਼ ਆਟੋਮੈਟ ਹੋਈ ਹੈ ਅਸੀਂ ਆਟੋਮੈਟਿਕ ਤਰੀਕੇ ਨਾਲ ਹੀ ਆਨਲਾਈਨ ਭੁਗਤਾਨ ਕਰ ਸਕਦੇ ਹਾਂ ਇੰਟਰਨੈਟ ਨਾਲ ਲੈਣ ਦੇਣ ਕਰ ਸਕਦੇ ਹਾਂ ਲੋਨ ਲੈ ਸਕਦੇ ਹਾਂ ਆਪਣੀਆਂ ਕਿਸ਼ਤਾਂ ਚੁੱਕਤਾ ਚੁਕਤਾ ਕਰ ਸਕਦੇ ਹਾਂ ਕਿਸੇ ਦੀ ਕਿਸ਼ਤ ਭਰਨੀ ਹੋਵੇ ਉਹ ਕਰ ਸਕਦੇ ਹਾਂ ਇਵੇਂ ਹੀ ਜਦੋਂ ਕੋਈ ਬੀਮਾ ਬੀਮੇ ਦੀ ਰਕਮ ਪੂਰੀ ਹੁੰਦੀ ਹੈ ਤਾਂ ਉਸ ਨੂੰ ਆਨਲਾਈਨ ਹੀ ਲੈ ਸਕਦੇ ਹਾਂ ਕਿਤੇ ਦਫਤਰ ਦੇ ਚੱਕਰ ਕੱਢਣ ਦੀ ਜ਼ਰੂਰਤ ਨਹੀਂ ਪੈਂਦੀ ਬਹੁਤ ਘੱਟ ਹੁਣ ਬੈਂਕਾਂ ਵਿੱਚ ਰੱਸ਼ ਘੱਟ ਹੋ ਗਿਆ ਹੈ ਘੱਟ ਦੇਖਣ ਨੂੰ ਮਿਲਦਾ ਰੱਸ਼ ਪਹਿਲਾਂ ਜਿ ਜਿਸ ਤਰ੍ਹਾਂ ਇਹਨਾਂ ਦੇ ਆਫਿਸ ਵਿੱਚ ਬਹੁਤ ਜ਼ਿਆਦਾ ਰਸ਼ ਪਿਆ ਰਹਿੰਦਾ ਸੀ ਲਾਈਨਾਂ ਲੱਗੀਆਂ ਰਹਿੰਦੀਆਂ ਸਨ ਹੁਣ ਇਹ ਬੈਕਿੰਗ ਭੁਗਤਾਨ ਲੈਣ ਦੇਣ ਦਾ ਤਰੀਕਾ ਆਨਲਾਈਨ ਟ੍ਰਾਂਜੈਕਸ਼ਨ ਕ੍ਰੈਡਿਟ ਕਾਰਡ ਆਦਿ ਦੀ ਵਜ੍ਹਾ ਨਾਲ ਸਾਡੀ ਜ਼ਿੰਦਗੀ ਕਾਫੀ ਸੁਰੱਖਿਅਤ ਹੋਈ ਹੈ ਲੇਕਿਨ ਇਸ ਦੇ ਨਾਲ ਨਾਲ ਕਰਾਈਮ ਵੀ ਵਧੇ ਹਨ ਲੋਕ ਝੂਠੀ ਟਰਾਂਜੈਕਸ਼ਨ ਕਰਕੇ ਵੀ ਪੈਸਾ ਕਮਾ ਲੈਂਦੇ ਹਨ ਲੋਕਾਂ ਨੂੰ ਬਹੁਤ ਘਾਟਾ ਵੀ ਪੈਂਦਾ ਹੈ ਲੇਕਿਨ ਇਸ ਦੇ ਬਾਵਜੂਦ ਬੈਕਿੰਗ ਨੇ ਸਾਰਾ ਸਿਸਟਮ ਸੌਖਾ ਕਰ ਦਿੱਤਾ ਹੈ